ਇਕ ਲੱਖ ਪੰਜਾਹ ਹਜ਼ਾਰ ਤਿੰਨ ਸੌ ਚਾਲੀ ਦੋ ਹਜ਼ਾਰ ਅੱਠ ਸੌ ਸਤਾਨਵੇਂ ਨੌਂ ਲੱਖ ਨੱਬੇ ਹਜ਼ਾਰ ਨੌਂ ਸੌ ਇਕਤਾਲੀ ਤੇਰਾਂ ਹਜ਼ਾਰ ਪੰਜ ਸੌ ਬਾਰਾਂ ਪੰਜਾਹ ਹਜ਼ਾਰ ਅੱਠ ਸੌ ਛੱਤੀ